ਹੈਲੋ ਬੋਲ ਰਹੇ ਹੋ ਤੁਹਾਡਾ ਮੋਬਾਇਲ ਦਾ ਕੰਮ ਹੈ ਸ਼ੌਕ ਐ ਕਿਹੜੀ ਸਾਈਡ ਤੁਹਾਡਾ ਆਪਣਾ ਆਪਣੀ ਸ਼ੋਪ ਐ ਮੈਨੂੰ ਇੱਕ ਸਮਾਰਟ ਫੋਨ ਚਾਹੀਦਾ ਸੀ ਇਸਦੀ ਕੰਪਨੀ ਦੇ ਅਵੇਲੇਬਲ ਨੇ ਤੁਹਾਡੇ ਕੋਲ ਤੇ ਕਿਸ ਰੇਂਜ ਤੋਂ ਸਟਾਰਟ ਐ ਓਕੇ ਉਹਦੇ ਵਿੱਚ ਕਿਹੜੇ ਕਿਹੜੇ ਕਲਰ ਅਵੇਲੇਬਲ ਨੇ ਕੁਝ ਫੀਚਰ ਦੇ ਬਾਰੇ ਦੱਸੋਗੇ ਕੋਈ ਐਮਆਈ ਤੇ ਵੀ ਉਹਨਾਂ ਦੀ ਫੈਸਿਲਿਟੀ ਹੈਗੀ ਆ ਈਐਮਆਈ ਕਿਸ ਰੇਂਜ ਤੋਂ ਉਹਨਾਂ ਦਾ ਬਣੇਗਾ ਅਗਰ ਮੈਂ ਲੈਨੀ ਫੋਨ ਤਾਂ ਉਹਨਾਂ ਦਾਂ ਕੀ ਸਿਸਟਮ ਰਹੇਗਾ ਪਰ ਕੋਈ ਇੰਟਰਸਟ ਵਗੈਰਾ ਤਾਂ ਨਹੀਂ ਪੈਂਦਾ ਕੋਈ ਕੰਪਲੇਂਟ ਉਹਨਾਂ ਦੀ ਸਰਵਿਸ ਵਗੈਰਾ ਕੋਈ ਸਰਵਿਸ ਵਿਚ ਪ੍ਰੋਬਲਮ ਤਾਂ ਨਹੀਂ ਆਏਗੀ ਤੇ ਜਦੋਂ ਮੈਂ ਤੁਹਾਨੂੰ ਮਿਲਣਾ ਚਾਹਵਾਂ ਤੁਹਾਨੂੰ ਸ਼ੋਪ ਤੇ ਹੀ ਮਿਲਾ ਜਾਂ ਕੋਈ ਹੋਰ ਐਡਰੈਸ ਠੀਕ ਕਿ ਕੋਈ ਪ੍ਰੋਬਲਮ ਨਹੀਂ ਆਏਗੀ ਮੈਨੂੰ ਖਰੀਦ ਦੇ 'ਚ ਕੋਈ ਡੁਪਲੀਕੇਟ ਦੀ ਪ੍ਰੋਬਲਮ ਜਾਂ ਕੁਝ ਉਹਨਾਂ ਦਾ ਚਾਰਜਰ ਵਗੈਰਾ ਫੋਨ ਦੇ ਨਾਲ ਨਾਲ ਕੀ ਹੋਰ ਚੀਜ਼ਾਂ ਕੀ ਹੈਗੀਆਂ ਨੇ ਨਾਲ ਆਫਿਸ ਵਿੱਚ ਕਿ ਮੈਂ ਜਲਦੀ ਹੀ ਤੁਹਾਨੂੰ ਸੰਪਰਕ ਕਰਨੀ ਆ ਮੈਂ ਜਲਦੀ ਤੁਹਾਨੂੰ ਕਾਲ ਆ ਮੈਂ ਖੁਦ ਆ ਕੇ ਮਿਲਾ ਥੈਂਕ ਯੂ ਹਾਂਜੀ